ਮੇਰੇ ਖਿਆਲ ਅਨੁਸਾਰ ਪੰਜਾਬੀ ਭਾਸ਼ਾ ਪੂਰੇ ਦੇ ਪੂਰੇ ਭਾਰਤ ਦੇ ਸੱਭਿਆਚਾਰਕ ਵਟਾਂਦਰੇ ਅਤੇ ਸੰਚਾਰ ਵਿੱਚ ਬਹੁਤ ਜ਼ਿਆਦਾ ਵੱਡੀ ਭੂਮਿਕਾ ਨਿਭਾਉਂਦੀ ਆ ਜਿਵੇਂ ਕਿ ਸੱਭਿਆਚਾਰਕ ਵਟਾਂਦਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਭੰਗੜਾ ਗਿੱਧਾ ਲੁੱਡੀ ਝੂਮਰ ਬਹੁਤ ਜ਼ਿਆਦਾ ਪਾਇਆ ਜਾਂਦਾ ਪੰਜਾਬੀ ਕੁੜਤਾ ਪਜ਼ਾਮਾ ਡਰੈਸ ਹੋ ਗਈ ਜਿਵੇਂ ਪਹਿਨ ਪਹਿਰਾਵੇ ਹੋ ਗਏ ਪੰਜਾਬੀ ਕੁੜਤਾ ਪਜ਼ਾਮਾ ਪੰਜਾਬੀ ਸੂਟ ਸਲਵਾਰ ਹੋ ਗਿਆ ਲਹਿੰਗਾ ਹੋ ਗਿਆ ਇਹ ਸਾਰੇ ਪੰਜਾਬੀ ਆਪਣੇ ਪਹਿਰਾਵੇ ਨੇ ਜਾਂ ਪੰਜਾਬੀ ਭਾਸ਼ਾ ਹੋ ਗਈ ਇਹ ਸੱ ਸੱਭਿਆਚਾਰਕ ਵਟਾਂਦਰੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਉਂਦੀ ਆ ਜਿਵੇਂ ਕਿ ਪੰਜਾਬੀ ਭਾਸ਼ਾ ਇੱਕ ਬਹੁਤ ਹੀ ਸਰਲ ਭਾਸ਼ਾ ਹੈ ਭਾਰਤ ਦੇ ਹੋਰ ਸ ਬਹੁਤ ਸਾਰੇ ਇਲਾਕਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਸਮਝਣ ਦੀ ਬਹੁਤ ਬ ਸਮਝਣ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਬਹੁਤ ਅਸਾਨੀ ਨਾਲ ਲੋਕ ਸਮਝ ਸਕਦੇ ਨੇ ਪੰਜਾਬੀ ਭਾਸ਼ਾ ਨੂੰ ਜਿਹਦੇ ਨਾਲ ਲੋਕਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਸੌਖਾ ਅਤੇ ਸਰਲ ਹੋ ਸਕਦਾ ਹੈ ਜਿਹਦੇ ਨਾਲ ਬਾਕੀ ਭਾਰਤ ਦੇ ਲੋਕ ਭੰਗੜਾ ਗਿੱਧੇ ਵਿੱਚ ਪੰਜਾਬੀ ਭਾਸ਼ਾ ਦੇ ਇੱਕ ਦੂਜੇ ਦੀ ਸਮਝ ਦੇ ਕਾਰਨ ਬਹੁਤ ਜ਼ਿਆਦਾ ਇੰਟਰਸਟ ਆਪਾਂ ਕਹਿ ਲਈਏ ਬਹੁਤ ਜਿਆਦਾ ਯੋਗਤਾ ਜਾਂ ਪ੍ਰਦਾਨ ਕਰ ਇੰਟਰਸਟ ਜਤਾਉਂਦੇ ਨੇ ਅਤੇ ਪੰਜਾਬੀ ਦੇ ਸੰਚਾਰ ਵੀ ਬਹੁਤ ਜ਼ਿਆਦਾ ਹੁੰਦਾ ਜੇਕਰ ਪੰਜਾਬੀ ਭਾਸ਼ਾ ਸਰਲ ਹੋਣ ਦੇ ਨਾਲ ਨਾਲ ਲੋਕਾਂ ਨੂੰ ਵਿੱਚ ਅ ਪ੍ਰਦਰਸ਼ਿਤ ਕਰਨੀ ਸਮਝਾਉਣਾ ਲੋਕਾਂ ਨੂੰ ਬਹੁਤ ਜ਼ਿਆਦਾ ਅਸਾਨ ਹੋ ਜਾਂਦਾ ਜਿਹਦੇ ਨਾਲ ਆਪਾਂ ਆਪਣੀਆਂ ਨਿੱਤ ਦੀਆਂ ਕੋਈ ਵੀ ਚੀਜ਼ਾਂ ਨੇ ਸਾਧਨ ਨੇ ਸਰੋਤ ਨੇ ਉਹਨਾਂ ਨਾਲ ਵਟਾਂਦਰਾ ਬਹੁਤ ਅਸਾਨੀ ਨਾਲ ਕਰ ਸਕਦੇ ਹਾਂ ਜਿਹਦੇ ਨਾਲ ਆਪਣਾ ਆਪਣੀਆਂ ਵਰਤੋਂ ਦੀਆਂ ਰੋਜ਼ਾਨਾ ਦੀਆਂ ਚੀਜ਼ਾਂ ਆਪਾਂ ਹੋਰਾਂ ਲੋਕਾਂ ਦੀ ਲਈ ਵੀ ਦੇ ਸਕਦੇ ਹਾਂ ਸੋ ਜੀ ਇੰਨਾ ਕਹਿੰਦੇ ਹੋਏ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਸਤਿ ਸ਼੍ਰੀ ਅਕਾਲ